ਮੇਰੇ ਦਾਦੇ ਦੁਆਰਾ ਪੁਰਾਣੇ ਇਕੱਠੇ ਕੀਤੇ ਸਿੱਕੇ ਅਤੇ ਮੇਰੇ ਫ਼ਾਦਰ ਦੁਆਰਾ ਇਕੱਠੇ ਕੀਤੇ ਸਿੱਕੇ ਉਹਨਾਂ ਦੀ ਯਾਦ ਦਵਾਉਂਦੇ ਰਹਿੰਦੇ ਹਨ ਅਤੇ ਉਹ ਬਹੁਤ ਕੀਮਤੀ ਹਨ ਅਤੇ ਹਰ ਵਾਰ ਪਰ ਇਹ ਪਤਾ ਲੱਗਦਾ ਹੈ ਵੀ ਇਹ ਕਿਸ ਸਾਲ ਦੇ ਸਿੱਕੇ ਹਨ ਕਿ ਕਿਸ ਤਰ੍ਹਾਂ ਹੈ ਨਵੇਂ ਸਿੱਕੇ ਹੋਰ ਆ ਪਿਛਲੇ ਸਾਲਾਂ ਦੇ ਕੁਛ ਹੋਰ ਤੇ ਉਹ ਹਰ ਟਾਇਮ ਪੁਰਾਣੀ ਯਾਦ ਦਵਾਉਂਦੇ ਰਹਿੰਦੇ ਹਨ ਅਤੇ ਬਹੁਤ ਕੀਮਤੀ ਹਨ